ਹੈਲੋ ਹਾਂਜੀ ਹਰਮਨ ਕੀ ਹਾਲ ਆ ਵੀਰ ਹੋਰ ਠੀਕ ਠਾਕ ਕਿਵੇਂ ਚਲਦੀ ਪੀ ਐੱਚ ਡੀ ਅੱਛਾ ਅੱਛਾ ਹਾਂਜੀ ਹਾਂਜੀ ਹਮ ਸਕਾਲਰਸ਼ਿਪ ਲੈਣ ਦੇ ਤਿੰਨ ਢੰਗ ਤਿੰਨ ਤਰੀਕੇ ਨੇ ਜੀ ਇੱਕ ਤਾਂ ਮਨਿਓਰਟੀ ਫੈਲੋਸ਼ਿਪ ਹੁੰਦੀ ਮੌਲਾਨਾ ਅਜ਼ਾਦ ਮਨਿਓਰਟੀ ਫੈਲੋਸ਼ਿਪ ਹੁੰਦੀ ਹੈ ਜਿਹਦੇ ਵਿੱਚ ਮਨਿਓਰਟੀ ਨੇ ਜਿਹੜੇ ਸਿੱਖ ਮੁਸਲਿਮ ਬੋਧੀ ਜੈਨੀ ਫਾਲ ਕਰਦੇ ਉਹ ਤੁਹਾਡੇ ਮਾਸਟਰਜ਼ ਦੇ ਵਿੱਚ ਜਿਹੜੇ ਨੰਬਰ ਨੇ ਉਹ ਜਿਹੜਾ ਉਹ ਕ੍ਰਾਈਟੀਰੀਆ ਬਣਾਉ ਫੋਲੋ ਕਰਨਗੇ ਉਹਦੇ ਵਿੱਚ ਤੁਸੀਂ ਫੋਲੋ ਕਰ ਜੂਗੇ ਫੋਲ ਕਰ ਜੂਗੇ ਤਾਂ ਫਿਰ ਤੁਸੀਂ ਤੁਹਾਨੂੰ ਸਕੋਲਰਸ਼ਿਪ ਮਿਲ ਜੇਗੀ ਦੂਜੀ ਜਿਹੜੀ ਹੈਗੀ ਉਹ ਰਜੀਵ ਗਾਂਧੀ ਨੈਸ਼ਨਲ ਸਕੋਲਰਸ਼ਿਪ ਹੁੰਦੀ ਹੈ ਸ਼ ਸ਼ਡਿਊਲ ਕਾਸਟ ਦੇ ਵਿਦਿਆਰਥੀਆਂ ਵਾਸਤੇ ਅਤੇ ਜੇ ਮਤਲਬ ਕਿ ਤੁਸੀਂ ਇਹਨਾਂ ਦੋਨਾਂ 'ਚ ਫਾਲ ਨਹੀਂ ਕਰਦੇ ਜਾਂ ਇਹਨਾਂ ਦੋਨਾਂ 'ਚੋਂ ਕਿਸੇ 'ਚ ਫਾਲ ਕਰਦੇ ਹੋਣ ਦੇ ਬਾਵਜੂਦ ਤੁਸੀਂ ਕ੍ਰੇਟੀਰੀਏ ਦੇ ਵਿੱਚ ਫਾਲ ਨਹੀਂ ਕੀਤਾ ਤਾਂ ਫਿਰ ਇੱਕ ਤਰੀਕਾ ਹੈਗਾ ਜੇ ਆਰ ਐੱਫ ਦਾ ਪੇਪਰ ਹੁੰਦਾ ਜਿਹੜਾ ਯੂ ਜੀ ਸੀ ਨੈਟ ਦਾ ਇਗਜ਼ਾਮ ਹੁੰਦਾ ਉਹਦੇ ਵਿੱਚ ਜਿਹੜੇ ਮਤਲਬ ਜਿਹੜੇ ਟੋਪਰ ਹੁੰਦੇ ਨੇ ਮਤਲਬ ਉੱਪਰਲੇ ਜਿੰਨੇ ਉਹਨਾਂ ਨੇ ਜੇ ਆਰ ਐੱਫ ਫੈਲੋਸ਼ਿਪ ਲਈ ਮਤਲਬ ਕਿ ਉਹਨਾਂ ਨੇ ਲੈਣੇ ਹੁੰਦੇ ਨੇ ਬੱਚੇ ਤਾਂ ਉਹਨਾਂ ਦੀ ਫੈਲੋਸ਼ਿਪ ਲੱਗ ਜਾਂਦੀ ਹੈ ਜੂਨੀਅਰ ਸਰਚ ਫੈਲੋਸ਼ਿਪ ਕਹਿੰਦੇ ਨੇ ਉਹਨੂੰ ਇੱਕ ਇਹ ਤਰੀਕਾ ਅਤੇ ਇਹ ਮਤਲਬ ਜਿਹੜੀ ਪੰਜ ਸਾਲ ਮਿਲਦੀ ਹੈ ਤੁਹਾਨੂੰ ਫੈਲੋਸ਼ਿਪ ਇਹ ਤਿੰਨ ਸਾਲ ਜੇ ਆਰ ਐੱਫ ਹੁੰਦੀ ਹੈ ਜੂਨੀਅਰ ਸਰਚ ਫੈਲੋਸ਼ਿਪ ਅਤੇ ਅਗਲੇ ਦੋ ਸਾਲ ਐੱਸ ਆਰ ਐੱਫ ਹੁੰਦੀ ਹੈ ਸੀਨੀਅਰ ਰਿਸਰਚ ਫੈਲੋਸ਼ਿਪ ਅਤੇ ਇਹਦਾ ਜਿਹੜਾ ਤੁਹਾਨੂੰ ਬੈਨੀਫਿਟ ਹਾਂ ਮਿਲਣੀ ਪੰਜ ਸਾਲ ਹੀ ਹੈ ਕਈ ਵਾਰ ਜਿਵੇਂ ਆਪਣੀ ਪੀ ਐਚ ਡੀ ਮਤਲਬ ਕਿ ਅੱਗੇ ਚਲੀ ਜਾਂਦੀ ਹੈ ਹੈ ਨਾ ਐਕਸਟੈਂਸ਼ਨ ਲੈ ਲੈਂਦੇ ਆ ਆਪਾਂ ਪੰਜ ਸਾਲ ਤੋਂ ਅੱਗੇ ਨਿਕਲ ਗਈ ਤਾਂ ਫਿਰ ਤੁਹਾਨੂੰ ਬੈਨੀਫਿਟ ਪੰਜ ਸਾਲ ਹੀ ਮਿਲੇਗਾ ਉਹ ਤੋਂ ਬਾਅਦ ਬੈਨੀਫਿਟ ਨਹੀਂ ਮਿਲਦਾ ਪੰਜ ਸਾਲ ਤੋਂ ਬਾਅਦ ਰਜਿਸਟ੍ਰੇਸ਼ਨ ਤੋਂ ਲੈ ਕੇ ਰਜਿਸਟ੍ਰੇਸ਼ਨ ਜਿੱਦਣ ਹੋ ਗਈ ਤੁਹਾਡੀ ਉੱਦਣ ਤੋਂ ਲੈ ਕੇ ਅਗਲੇ ਪੰਜ ਸਾਲ ਹਾਂਜੀ ਹਾਂਜੀ ਹਾਂ ਇੱਕ ਜਾਂ ਤਾਂ ਤੁਸੀਂ ਜਿਵੇਂ ਆਪਾਂ ਉਹ 'ਚ ਆਉਂਦੇ ਹਾਂ ਮਨਿਓਰਟੀ ਦੇ ਤੌਰ 'ਤੇ ਸਿੱਖ ਮਨਿਓਰਟੀ 'ਚ ਆਉਂਦੇ ਨੇ ਦੂਜੀ ਮੌਲਾਨਾ ਅਜ਼ਾਦ ਵਾਲੀ ਅਪਲਾਈ ਕਰ ਲਓ ਪਹਿਲਾਂ ਅਤੇ ਨਾਲੇ ਪੇਪਰ ਦੀ ਤਿਆਰੀ ਵੀ ਕਰ ਲਉ ਜੇ ਮਤਲਬ ਕਿ ਇਹਦੇ 'ਚ ਆ ਗਿਆ ਤਾਂ ਠੀਕ ਹੈ ਨਹੀਂ ਤਾਂ ਫਿਰ ਪੇਪਰ ਦੇ ਲਿਓ ਕਿਉਂਕਿ ਉੱਦਾਂ ਵੀ ਆਪਾਂ ਨੂੰ ਨੈਟ ਦਾ ਪੇਪਰ ਤਾਂ ਆਪਾਂ ਕਰਨਾ ਹੀ ਪੈਣਾ ਪਾਸ ਅਲਿਜੀਬਲ ਅਲਿਜੀਬਿਲਟੀ ਵਾਸਤੇ ਉਹਦੀ ਤਿਆਰੀ ਕਰਕੇ ਪੇਪਰ ਹੀ ਦੇ ਲਓ ਤੁਹਾਨੂੰ ਨਾਲੇ ਤਾਂ ਜੇ ਆਰ ਐੱਫ ਹੋ ਗਈ ਤੁਹਾਨੂੰ ਉਹਦਾ ਬੈਨੀਫਿਟ ਮਿਲੇਗਾ ਫੈਲੋਸ਼ਿਪ ਦਾ ਅਤੇ ਤੁਸੀਂ ਨਾਲੇ ਅਸਿਸਟੈਂਟ ਪ੍ਰੋਫੈਸਰ ਅਲਿਜੀਬਲ ਹੋਜੋਂਗੇ ਨੈਟ ਵੀ ਕੁਆਲੀਫਾਈ ਹੋਜੂਗਾ ਤੁਹਾਡਾ ਹਾਂਜੀ ਹਾਂਜੀ ਹਾਂਜੀ ਓਕੇ ਜੀ ਠੀਕ ਹੈ ਜੀ ਓਕੇ